ਸਤਿ ਸ਼੍ਰੀ ਅਕਾਲ ਜੀ ਭਾਰਤ ਵਿੱਚ ਕਈ ਪ੍ਰਕਾਰ ਦੀਆਂ ਪਰੰਪਰਾਗਤ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਹਨਾਂ ਵਿੱਚੋਂ ਮੈਂ ਕੁਛ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਵਾਂਗੀ ਜਿਵੇਂ ਕਿ ਪੰਜਾਬ ਵਿੱਚ ਕੁਸ਼ਤੀ ਮਹਾਰਾਸ਼ਟਰ ਵਿੱਚ ਲੈਜੀਮ ਤਮਿਲਨਾਡੂ ਵਿੱਚ ਜਲੀ ਕੱਟੂ ਅਤੇ ਅਸਾਮ ਵਿੱਚ ਧੂਧ ਖੇਦ ਇੱਦਾਂ ਦੀਆਂ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਕਈ ਪ੍ਰਕਾਰ ਦੀਆਂ ਖੇਡਾਂ ਹਨ ਜਿਵੇਂ ਕਿ ਖੋ ਖੋ ਕਬੱਡੀ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਜਿਹਨਾਂ ਵਿੱਚੋਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਬੱਡੀ ਰਾਸ਼ਟਰੀ ਪਦ ਦੇ ਉੱਤੇ ਪਹੁੰਚ ਚੁੱਕੀ ਹੈ ਇਸ ਵਿੱਚ ਨੌਜਵਾਨ ਵੀ ਕੁੜੀਆਂ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਅੱਜ ਕੱਲ੍ਹ ਤਾਂ ਕੁੜੀਆਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਹਨ ਅਤੇ ਇਸ ਨੂੰ ਬੜੀ ਹੀ ਚੰਗੀ ਖੇਡ ਮੰਨਿਆ ਜਾਂਦਾ ਹੈ ਇਸ ਨੂੰ ਖੇਡ ਕੇ ਸਾਡਾ ਕਈ ਤਰ੍ਹਾਂ ਦਾ ਵਿਕਾਸ ਹੁੰਦਾ ਹੈ ਅਤੇ ਮੈਂ ਸੈਲਾਨੀਆਂ ਨੂੰ ਇਹੀ ਦੱਸਣਾ ਚਾਹਵਾਂਗੀ ਕਿ ਇਸ ਵ ਇਸ ਥਾਂ 'ਤੇ ਕਈ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ ਅਤੇ ਧੰਨਵਾਦ